ਮੇਰੇ ਪੰਜਾਬੀ ਮਨ ਪਸੰਦ ਸ਼ਬਦ ਭੈਣੋ ਅਤੇ ਭਰਾਵੋ ਮੇਰੇ ਪੰਜਾਬੀਓ ਮੇਰੇ ਸੱਭਿਆਚਾਰਕ ਮੇਰੇ ਦੋਸਤੋ ਮੇਰੇ ਮਿੱਤਰੋ ਹਨ ਇਸ ਸ਼ਬਦ ਨੂੰ ਬੋਲ ਕੇ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿਉਂਕਿ ਇਹ ਸ਼ਬਦ ਬਹੁਤ ਹੀ ਜ਼ਿਆਦਾ ਸਤਿਕਾਰ ਨੂੰ ਸਮਰਪਿਤ ਕਰਦਾ ਹੈ ਸਤਿਕਾਰ ਨਾਲ ਸੰਬੰਧਿਤ ਹੁੰਦਾ ਹੈ ਸਤਿਕਾਰ ਨੂੰ ਸੰਬੋਧਨ ਕਰਦਾ ਹੈ ਇਹ ਸ਼ਬਦ ਬਹੁਤ ਹੀ ਜ਼ਿਆਦਾ ਵਧੀਆ ਹਨ ਅਗਰ ਆਪਾਂ ਇਹਨਾਂ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਤਾਂ ਆਪਣੇ ਲਈ ਹਰ ਕੰਮ ਬਹੁਤ ਹੀ ਜ਼ਿਆਦਾ ਆਸਾਨ ਬਣ ਜਾਂਦਾ ਗਾ ਇਹ ਸ਼ਬਦ ਬਹੁਤ ਜ਼ਿਆਦਾ ਤਰੱਕੀ ਕਰਵਾਉਂਦੇ ਹਨ ਅਗਰ ਆਪਾਂ ਸੱਭਿਆਚਾਰ ਵਿੱਚ ਮੇਰੇ ਭੈਣੋ ਅਤੇ ਭਰਾਵੋ ਸ਼ਬਦ ਦਾ ਵਰਤੋਂ ਕਰਦੇ ਹਾਂ ਤਾਂ ਇਹ ਆਪਣੇ ਲਈ ਬਹੁਤ ਹੀ ਜ਼ਿਆਦਾ ਚੰਗੀ ਹੁੰਦੀ ਹੈ